ਮੈਂ ਆਪਣੇ ਇਲਾਕੇ ਦੇ ਵਿੱਚੋਂ ਬਸੀ ਤੋਂ ਗੁਰਪ੍ਰੀਤ ਸਿੰਘ ਜੀ ਨੂੰ ਜਾਣਦੀ ਹਾਂ ਜੋ ਕਿ ਝਾੜੂ ਦੇ ਵਿਧਾਇਕ ਸੀ ਅਤੇ ਓਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਕੀਤੇ ਅਤੇ ਮੈਂ ਓਹਨਾਂ ਦੇ ਕੰਮਾਂ ਤੋਂ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੋਈ ਅਤੇ ਓਹਨਾਂ ਨੇ ਇੱਕ ਨਾਗਰਿਕ ਵਜੋਂ ਸਾਡੇ ਪਿੰਡ ਦੇ ਵਿੱਚ ਸੁਹਾਵੇ ਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਦਿੱਤੀਆਂ ਸਨ ਅਤੇ ਓਹਨਾਂ ਤੋਂ ਪਿਛਲੇ ਜਿਹੜੇ ਐੱਮ ਐੱਲ ਏ ਰਹੇ ਹੈ ਹਲਕਾ ਬਸੀ ਪਠਾਣਾਂ ਤੋਂ ਗੁਰਪ੍ਰੀਤ ਸਿੰਘ ਜੀ ਪੀ ਜੀ ਨੇ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਗ੍ਰਾਂਟ ਦਵਾਉਣ ਦੇ ਵਿੱਚ ਵੀ ਓਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਅਤੇ ਉਹਨਾਂ ਨੇ ਸਾਡੇ ਪਿੰਡ ਸਰਪੰਚ ਦੇ ਨਾਲ ਮਿਲ ਕੇ ਬਹੁਤ ਹੀ ਜ਼ਿਆਦਾ ਕੰਮ ਕਰਵਾਏ ਸਾਡੇ ਪਿੰਡ ਦੇ ਟੋਬੇ ਦੀ ਸਫ਼ਾਈ ਦਾ ਕੰਮ ਕਰਵਾਉਂਦੇ ਆ ਸਾਡੇ ਪਿੰਡ ਦੇ ਵਾਟਰ ਸਪਲਾਈ ਦਾ ਕੰਮ ਕਰਵਾਉਣ ਦੇ ਵਿੱਚ ਓਹਨਾਂ ਨੇ ਸਾਡੇ ਪਿੰਡ ਦੀ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ